ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਹੀ ਵਧੀਆ ਸੁਵਿਧਾ ਸੁਵਿਧਾ ਦਿੱਤੀ ਜਾ ਰਹੀ ਹੈ ਜਿਵੇਂ ਕਿ ਨਵੀਆਂ ਨਵੀਆਂ ਮਸ਼ੀਨਾਂ ਲਿਆਂਦੀਆਂ ਜਾ ਰਹੀਆਂ ਨੇ ਤਾਂ ਜੋ ਮਰੀਜ਼ਾਂ ਨੂੰ ਬਾਹਰ ਟੈਸਟ ਕਰਵਾਉਣ ਨਾ ਜਾਣਾ ਪਵੇ ਅਤੇ ਹਸਪਤਾਲ ਦੇ ਅੰਦਰ ਹੀ ਉਹਨਾਂ ਦੇ ਸਾਰੇ ਟੈਸਟ ਹੋ ਜਾਣ ਜਿਵੇਂ ਕਿ ਮੈਂ ਹੁਣੇ ਥੋੜ੍ਹੇ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਰਜਿੰਦਰਾ ਹੋਸਪਿਟਲ ਵਿਜਿਟ ਕੀਤਾ ਅਤੇ ਮੈਨੂੰ ਪਤਾ ਲੱਗਿਆ ਕਿ ਉੱਥੇ ਅਲਟਰਾਸਾਊਂਡ ਦੀਆਂ ਲੇਟੈਸਟ ਮਸ਼ੀਨਾਂ ਆਈਆਂ ਹਨ ਸਾਨੂੰ ਨਵੇਂ ਹਸ ਹਸਪਤਾਲ ਬਜਾ ਬਣਾਉਣ ਦੀ ਬਜਾਏ ਪੁਰਾਣੇ ਹਸਪਤਾਲਾਂ ਨੂੰ ਹੀ ਅਪਗ੍ਰੇਡ ਕਰਨਾ ਤਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਉੱਥੇ ਤੋਂ ਵੱਧ ਤੋਂ ਵੱਧ ਸੇਵਾਵਾਂ ਮਿਲ ਸਕਣ ਲੋਕਾਂ ਨੂੰ ਆਪਣਾ ਸ਼ਹਿਰ ਛੱਡ ਕੇ ਦੂਜੇ ਸ਼ਹਿਰਾਂ ਦੇ ਵਿੱਚ ਜਾ ਕੇ ਇਲਾਜ ਲਈ ਨਾ ਜਾਣਾ ਪਵੇ ਜੇ ਸਾਡੇ ਆਪਣੇ ਹੀ ਸ਼ਹਿਰ ਦੇ ਹਸਪਤਾਲਾਂ ਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣ ਤਾਂ ਸਾਡੇ ਇੱਥੇ ਦੇ ਮਰੀਜ਼ਾਂ ਨੂੰ ਬਾਹਰ ਵਾਲੇ ਸਟੇਟਾਂ ਦੇ ਵਿੱਚ ਜਾ ਕੇ ਇਲਾਜ ਨਹੀਂ ਏ ਕਰਵਾਉਣਾ ਪਵੇਗਾ ਮੈਂ ਇਹ ਰਿਕੁਐਸਟ ਕਰਦੀ ਹਾਂ ਕਿ ਜਿਹੜੇ ਸਾਡੇ ਐਗਜਿਸਟਿੰਗ ਹਸਪਤਾਲ ਹਨ ਉਹਨਾਂ ਦੀ ਕੁਆਲਿਟੀ ਉਹਨਾਂ ਦੇ ਡੋਕਟਰਾਂ ਨੂੰ ਇਮ ਨਵੇਂ ਸਪੈਸ਼ਲਿਸਟ ਡੋਕਟਰਸ ਲਿਆਉਂਦੇ ਜਾਣ ਤਾਂ ਜੋ ਇੱਥੇ ਹੀ ਹਰ ਤਰ੍ਹਾਂ ਦਾ ਇਲਾਜ ਸੰਭਵ ਹੋ ਸਕੇ